ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ

ਜੀ ਜੀ ਜੀ ਆਪਣੇ ਪ੍ਰੋਗਰਾਮ ਕਿਸ ਡੇਟ ਦਾ ਬੇਟਾ ਅੱਛਾ ਤੁਸੀਂ ਕਿੰਨੇ ਕੁ ਸਮਾਉਣੇ ਕੁੜਤੇ ਪਜਾਮੇ ਬੇਟਾ ਅੱਛਾ ਬੇਟਾ ਤੁਸੀਂ ਟਾਈਮ ਕੱਢ ਕੇ ਆਪਣੇ ਜਿਹੜਾ ਚੌਂਕ ਆਉਂਦਾ ਨਾ ਹੁੰਢਾਏ ਵਾਲਾ ਉੱਥੇ ਆਪਣਾ ਸ਼ੋਰੂਮ ਆ ਤੁਸੀਂ ਉੱਥੇ ਆ ਕੇ ਮੈਨੂੰ ਮਿਲੋ ਇੱਕ ਵਾਰ ਜਿੰਨੇ ਵੀ ਤੁਹਾਡੇ ਦੋਸਤ ਆ ਫਰੈਂਡ ਆ ਜਾਂ ਤੁਹਾਡੇ ਰਿਸ਼ਤੇਦਾਰ ਨੇ ਸਿਲਾਈ ਕਰਵਾਉਣੀ ਹੈ ਅਤੇ ਆਪਾਂ ਬਹਿ ਕੇ ਤੁਹਾਨੂੰ ਰੇਟ ਵਗੈਰਾ ਦੱਸ ਦਵਾਂਗੇ ਨਾਲੇ ਜੋ ਵੀ ਤੁਸੀਂ ਕਹੋਗੇ ਤੁਹਾਨੂੰ ਉਹ 'ਚ ਸਿਲਾਈ ਕਰਕੇ ਦੇਵਾਂਗੇ ਅਤੇ ਨਾਲੇ ਜੋ ਵੀ ਡੇਟ ਤੁਸੀਂ ਮੈਨੂੰ ਫਾਈਨਲ ਦੱਸ ਦਿਓ ਉਹ ਡੇਟ ਤੋਂ ਪਹਿਲਾਂ ਪਹਿਲਾਂ ਆਪਾਂ ਤੁਹਾਡੇ ਕੁੜਤੇ ਪਜਾਮੇ ਤੁਹਾਨੂੰ ਤਿਆਰ ਕਰਕੇ ਦੇ ਦਵਾਂਗੇ ਹੋਰ ਪੈਂਟ ਕੋਟ ਵੀ ਸਿਲਾਉਣੇ ਆ ਪੁੱਤ ਕਈ ਤਰ੍ਹਾਂ ਦੇ ਆ ਬੇਟਾ ਹੁਣ ਮੈਂ ਤੁਹਾਨੂੰ ਐਂ ਸਮਝਾ ਨਹੀਂ ਸਕਦਾ ਜਾਂ ਤਾਂ ਤੁਸੀਂ ਸ਼ੋਪ 'ਤੇ ਆਓ ਤੁਸੀਂ ਉੱਥੇ ਦੇਖੋ ਕਲਰ ਪਸੰਦ ਕਰੋ ਵਰਾਇਟੀ ਪਸੰਦ ਕਰੋ ਬੇਟਾ ਹਾਂ ਜੋ ਕਹੋਗੇ ਸਭ ਸੇਵਾ ਤੁਹਾਡੀ ਕਰਾਂਗੇ ਬੇਟਾ ਜੀ ਤੁਸੀਂ ਇੱਕ ਵਾਰੀ ਸ਼ੋਪ 'ਤੇ ਆਓ ਨਾ ਹਾਂਜੀ ਹਾਂਜੀ ਸਭ ਕੁਛ ਜੋ ਤੁਸੀਂ ਕਹੋਗੇ ਜਿਵੇਂ ਨਵੇਂ ਟਰੈਂਡ ਚੱਲ ਰਿਹਾ ਪਠਾਨੀ ਹੋ ਗਏ ਉਹ ਵੀ ਸਭ ਕੁਛ ਆਪਣੇ ਕੋਲ ਆਪਣਾ ਤੁਸੀਂ ਇੰਸਟਾਗਰਾਮ ਦੇਖਿਆ ਨਹੀਂ ਮੇਰਾ ਬਹੁਤ ਜ਼ਿਆਦਾ ਵੀਡੀਓ ਆ ਕਰਨ ਔਜਲਾ ਹੋਇਆ ਆਪਣਾ ਜੀ ਖਾਨ ਆਪਣਾ ਇੱਕ ਮੁੰਡਾ ਭਦੌੜ ਵਾਲਾ ਹੋਰ ਆ ਅਰਸ਼ਵਿੰਦਰ ਅਰਜਨ ਵੀ ਹਾਂ ਹਾਂ ਹਾਂ ਭਦੌੜ ਵਾਲੇ ਦੋਨੋਂ ਮੁੰਡੇ ਤਿੰਨ ਮੁੰਡੇ ਆਪਣੇ ਕੋਲ ਆਉਂਦੇ ਹੁੰਦੇ ਆ ਤੁਸੀਂ ਮੇਰਾ ਪੇਜ ਚੈੱਕ ਕਰੋ ਬੇਟਾ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਤੁਹਾਨੂੰ ਪੂਰਾ ਤਸੱਲੀ ਕਰਾਵਾਂਗੇ ਬੇਟਾ ਤੁਸੀਂ ਇੱਕ ਵਾਰੀ ਦੁਕਾਨ 'ਤੇ ਮਿਲੋ ਐਂ ਫੋਨ 'ਤੇ ਨਾ ਸਵਾਦ ਨਹੀਂ ਆਉਂਦਾ ਹੈਗਾ ਨਾ ਤੁਸੀਂ ਮੇਰੇ ਬਾਰੇ ਖੁੱਲ੍ਹ ਕੇ ਜਾਣ ਸਕਦੇ ਹੋ ਸੋ ਜੋ ਮੇਰੇ ਇੱਥੇ ਕੱਪੜੇ ਤਿਆਰ ਕੀਤੇ ਪਏ ਨੇ ਤੁਸੀਂ ਉਹਨੂੰ ਦੇਖੋਗੇ ਤੁਹਾਨੂੰ ਫੇਰ ਪਤਾ ਲੱਗੇਗਾ ਬੇਟਾ ਉਹ ਵੀ ਤੁਹਾਨੂੰ ਦੱਸ ਪਾ ਦਵਾਂਗੇ ਨਾਲ ਹੀ ਆਪਣੇ ਮਿੱਤਰ ਦੀ ਦੁਕਾਨ ਹੈ ਉਹਦੇ ਬਾਰੇ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਤੁਸੀਂ ਇੱਕ ਵਾਰੀ ਆ ਜਾਣਾ ਟਾਈਮ 'ਚੋਂ ਟਾਈਮ ਕੱਢ ਕੇ ਨਾ ਤੁਸੀਂ ਮਿਲੋ ਤੁਹਾਨੂੰ ਫਿਰ ਸਾਰਾ ਜੋ ਤੁਸੀਂ ਦੇਖੋਗੇ ਸ਼ੋਰੂਮ 'ਚ ਕੱਪੜੇ ਦੀ ਵਰਾਈਟੀ ਦੇਖੋਗੇ ਫਿਰ ਜੋ ਆਪਣੇ ਸਟੀਚ ਕੀਤੇ ਹੋਏ ਆ ਪਠਾਨੀ 'ਚ ਕੀਤੇ ਹੋਏ ਆ ਵੈਲ ਬੋਟਨ 'ਚ ਕੀਤੇ ਹੋਏ ਆ ਅਤੇ ਜਿਵੇਂ ਹੁਣ ਨਵਾਂ ਅਸੀਂ ਥੋੜ੍ਹਾ ਜਿਹਾ ਕੀਤਾ ਸੀਗਾ ਕੁੜਤਾ ਪਜਾ ਕੁੜਤਾ ਜੀ ਬੇਟਾ

ਠੀਕ ਹੈ ਬੇਟਾ ਜੀ ਠੀਕ ਹੈ